ਸਤਿ ਸ਼੍ਰੀ ਅਕਾਲ ਸਰ ਸਰ ਮੈਂ ਆਪਣੀ ਸਹੇਲੀ ਤੋਂ ਸੁਣਿਆ ਕਿ ਸਾਡੇ ਸ਼ਹਿਰ ਇੱਕ ਨਵਾਂ ਰੈਸਟੋਰੈਂਟ ਖੁੱਲ੍ਹਿਆ ਹੈਗਾ ਅਤੇ ਮੈਂ ਉਸ ਬਾਰੇ ਜਾਣਕਾਰੀ ਲੈਣਾ ਚਾਹੁੰਦੀ ਹਾਂ ਕਿ ਆਪਣੇ ਜਿਹੜਾ ਤੁਹਾਡਾ ਰੈਸਟੋਰੈਂਟ ਤੁਸੀਂ ਨਵਾਂ ਖੋਲ੍ਹਿਆ ਇਹਦੇ 'ਚ ਕੀ ਕੀ ਮਿਲਦਾ ਮਤਲਬ ਅਸੀਂ ਮਿਡਲ ਕਲਾਸ ਫੈਮਲੀ ਤੋਂ ਬਿਲੋਂਗ ਕਰਦੇ ਹਾਂ ਅਤੇ ਬਾਹਰ ਮੈਂ ਤਕਰੀਬਨ ਮੈਂ ਨੌਕਰੀ ਸ਼ੁਦਾ ਹੈਗੀ ਹਾਂ ਨੌਕਰੀ ਕਰਨ ਵਾਲੀ ਹਾਂ ਅਤੇ ਸ਼ਾਮ ਨੂੰ ਬੱਚਿਆਂ ਦੇ ਨਾਲ ਖਾਣਾ ਖਾਣ ਬਾਹਰ ਚਲੇ ਜਾਈਦਾ ਅਤੇ ਮਿਡਲ ਕਲਾਸ ਹਾਂ ਅਸੀਂ ਮਤਲਬ ਨਾ ਜ਼ਿਆਦਾ ਮਹਿੰਗਾ ਅਤੇ ਨਾ ਹੀ ਬਹੁਤਾ ਸਸਤਾ ਅਤੇ ਵਧੀਆ ਰੈਸਟੋਰੈਂਟ 'ਚ ਖਾਣਾ ਖਾਣਾ ਪਸੰਦ ਕਰਦੇ ਹਾਂ ਅਤੇ ਜਦੋਂ ਨਾ ਮੈਂ ਤੁਹਾਡੇ ਰੈਸਟੋਰੈਂਟ ਦਾ ਸੁਣਿਆ ਤੇ ਮੈਂ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੀ ਹਾਂ ਵੀ ਇੱਥੇ ਕੀ ਕੀ ਮਿਲਦਾ ਹੈ ਫਾਸਟ ਫੂਡ ਚਾਈਨੀਜ਼ ਕਿ ਇੰਡੀਅਨ ਥਾਲੀ ਅਤੇ ਮਤਲਬ ਮਿਕਦਾਰ ਕਿੰਨੀ ਹੋਊਗੀ ਉਹਨਾਂ ਦੀ ਜੇ ਅਸੀਂ ਜਿਵੇਂ ਮੰਨ ਲਓ ਦਾਲ ਮੱਖਣੀ ਜਾਂ ਸ਼ ਕੜ੍ਹਾਈ ਪਨੀਰ ਜਾਂ ਪਾਲਕ ਪਨੀਰ ਮੰਗਾਉਣੇ ਤਾਂ ਉਹ ਇੱਕ ਪਲੇਟ ਦਾ ਦੀ ਕੀਮਤ ਕੀ ਹੈ ਅਤੇ ਉਹਦੀ ਕੁਆਂਟੀਟੀ ਕਿੰਨੀ ਹੈ ਮਤਲਬ ਕਿਸ ਹਿਸਾਬ ਨਾਲ ਹੈ ਮਿਕਦਾਰ ਉਹਦੀ ਉਹ ਪੁੱਛਣਾ ਚਾਹੁੰਦੀ ਹਾਂ ਅਤੇ ਬਾਕੀ ਕੁਆਲਿਟੀ ਕੀ ਆ ਅਤੇ ਜਿਵੇਂ ਜੇ ਮੰਨ ਲਓ ਅਸੀਂ ਹੁਣ ਸਪੈਸ਼ਲ ਥਾਲੀ ਪਰਿਵਾਰ ਦੇ ਨਾਲ ਆਉਂਦੇ ਹਾਂ ਤੇ ਵੀ ਇੱਕ ਥਾਲੀ ਨਾਲ ਦੋ ਜਣੇ ਦੋ ਜਣੇ ਖਾ ਸਕਣ ਅਤੇ ਇੱਕ ਥਾਲੀ ਦੇ ਵਿੱਚ ਮਤਲਬ ਤੁਸੀਂ ਕੀ ਕੀ ਚੀਜ਼ਾਂ ਦਿੰਦੇ ਹੋ ਜਿਵੇਂ ਹੁਣ ਅਸੀਂ ਕਈ ਰੈਸਟੋਰੈਂਟ 'ਤੇ ਜਾਈਦਾ ਅਤੇ ਉਹ ਜਿਵੇਂ ਉਹਦੇ 'ਚ ਦੋ ਤਾਂ ਸਬਜ਼ੀਆਂ ਹੋ ਗਈਆਂ ਜਿਵੇਂ ਪਨੀਰ ਜਾਂ ਦਾਲ ਮੱਖਣੀ ਹੋ ਗਈ ਅਤੇ ਸੈਲਡ ਵਗੈਰਾ ਵੀ ਹੋ ਗਿਆ ਅਤੇ ਦਹੀਂ ਹੋ ਗਿਆ ਅਤੇ ਦੋ ਜਾਂ ਤਾਂ ਦੋ ਪਰੌਂਠੇ ਅਤੇ ਜਾਂ ਰੋਟੀਆਂ ਦੀ ਹੁੰਦੀ ਤਾਂ ਤੁਹਾਡਾ ਮੈਂ ਪੁੱਛਣਾ ਸ ਚਾਹੁੰਦੀ ਹਾਂ ਸਰ ਕਿ ਤੁਹਾਡਾ ਇੱਕ ਥਾਲੀ ਮਤਲਬ ਕਿੰਨੇ ਦੀ ਹੈ ਅਤੇ ਕੀ ਕੀ ਤੁਸੀਂ ਉਹਦੇ 'ਚ ਪਰੋਸਦੇ ਹੋ ਅਤੇ ਹੋਰ ਕੀ ਕੀ ਹੈ ਤੁਹਾਡੇ ਜਿਹੜੇ ਰੈਸਟੋਰੈਂਟ ਦੀ ਖਾਸੀਅਤ ਜਿਹੜਾ ਨਵਾਂ ਖੋਲਿਆ ਉਹਦੀ ਖਾਸੀਅਤ ਕੀ ਹੈਗੀ ਹੈ ਮੈਂ ਇਹ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਅਤੇ ਮਤਲਬ ਜੇ ਸਾਨੂੰ ਇਹ ਜੇ ਜਾਣਕਾਰੀ ਤੁਸੀਂ ਦਿਓ ਜੇ ਸਾਨੂੰ ਲੱਗਿਆ ਵਧੀਆ ਲੱਗਿਆ ਤੁਹਾਡੀ ਕੁਆਲਟੀ ਜਾਂ ਕੁਆਂਟੀਟੀ ਜਿੰਨੀ ਮਿਕਦਾਰ ਤਾਂ ਫਿਰ ਸਰ ਅਸੀਂ ਇੱਥੇ ਹੀ ਆਇਆ ਕਰਾਂਗੇ